ਮੈਂ ਘਰ ਵਿੱਚ ਆਰਾਮ ਨਾਲ ਬੈਠੀ ਸੀ ਟੀ ਵੀ ਦੇਖ ਰਹੀ ਸੀ ਅਤੇ ਅਚਾਨਕ ਹੀ ਸਾਡੇ ਘਰ ਦੀ ਪੂਰੀ ਲਾਈਟ ਚਲੀ ਜਾਂਦੀ ਹੈ ਫਿਰ ਮੈਂ ਇੱਕ ਮੋਮਬੱਤੀ ਲਈ ਅਤੇ ਆਪਣੇ ਘਰ ਤੋਂ ਬਾਹਰ ਗਈ ਅਤੇ ਦੇਖਿਆ ਕਿ ਸਾਡੇ ਗੁਆਂਡ ਵਿੱਚ ਵੀ ਚਾਰ ਪੰਜ ਘਰਾਂ ਵਿੱਚ ਬਿਜਲੀ ਨਹੀਂ ਸੀ ਇਸ ਦੇ ਲਈ ਮੈਨੂੰ ਲੱਗਦਾ ਕਿ ਸ਼ੋਟ ਬ ਸ਼ੋਟ ਸਰਕਟ ਹੋਇਆ ਹੈ ਜਿਸ ਦੇ ਲਈ ਮੈਂ ਬਿਜਲੀ ਬੋਰਡ ਨੂੰ ਇੱਕ ਐਮਰਜੈਂਸੀ ਕੋਲ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿ ਸਾਡੇ ਘਰ ਦੀ ਬਿਜਲੀ ਗਈ ਚਲੀ ਹੈ ਜਾਂ ਸ਼ੋਟ ਸਰਕਟ ਹੋ ਗਿਆ ਹੈ ਅਤੇ ਇਹ ਇਕੱਲੀ ਮੇਰੇ ਘਰ ਵਿੱਚ ਹੀ ਨਹੀਂ ਮੇਰੇ ਘਰ ਤੋਂ ਬਾਹਰ ਵੀ ਇਹ ਲਾਈਟ ਨਹੀਂ ਹੈ ਇਸ ਦੇ ਲਈ ਤੁਸੀਂ ਆਓ ਅਤੇ ਸ਼ੋਟ ਸਰਕਟ ਦੀ ਜਾਂਚ ਕਰੋ ਅਤੇ ਬਿਜਲੀ ਨੂੰ ਮੁੜ ਤੋਂ ਚਾਲੂ ਕਰੋ